ਸੱਤ ਅਗਸਤ ਦੋ ਹਜ਼ਾਰ ਪੰਜ ਅਠਾਰ੍ਹਾਂ ਨਵੰਬਰ ਦੋ ਹਜ਼ਾਰ ਛੇ ਇੱਕੀ ਦਸੰਬਰ ਦੋ ਹਜ਼ਾਰ ਚੌਦ੍ਹਾਂ ਪੱਚੀ ਦਸੰਬਰ ਨਾਇਨਟੀਨ ਏਟੀ ਵੰਨ ਇੱਕ ਜਨਵਰੀ ਉੱਨੀ ਸੌ ਇਕਿਆਸੀ